ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਅ ਤੁਸੀਂ ਪਲੇਸਮੈਂਟ ਏਜੰਸੀ ਤੋਂ ਬੋਲ ਰਹੇ ਸਰ ਮੈਂ ਨਾ ਜੋਬ ਦੀ ਤਲਾਸ਼ ਦੇ ਵਿੱਚ ਸੀ ਅਤੇ ਮੈਨੂੰ ਕਾਈਂਡਲੀ ਤੁਸੀਂ ਗਾਈਡ ਕਰ ਸਕਦੇ ਹੋ

ਹਾਂਜੀ ਸਰ ਹਾਂਜੀ

ਹਾਂਜੀ ਸਰ ਐੱਮ ਕੋਮ ਬੀ ਐੱਡ ਹੈ ਮੇਰੀ ਕੁਆਲੀਫਿਕੇਸ਼ਨ ਉਹਦੇ ਹਿਸਾਬ ਨਾਲ ਤੁਸੀਂ ਮੈਨੂੰ ਗਾਈਡ ਕਰ ਸਕਦੇ ਹੋ ਕਿ ਮੈਂ ਕਿਹੜੀ ਲਾਈਨ ਵਿੱਚ ਜਾਵਾਂ ਹਾਂਜੀ ਜੇ ਟੀਚਿੰਗ 'ਚ ਜਾਣਾ ਹੋਵੇ ਤਾਂ ਥੋੜ੍ਹਾ ਗਾਈਡ ਕਰ ਦਿਉ ਹਾਂਜੀ ਇਨਸ਼ੋਰੈਂਸ ਵਾਲੀ ਲਾਈਨ 'ਚ ਜਾਣਾ ਹੋਵੇ ਤਾਂ ਫਿਰ ਕੀ ਕ੍ਰਾਟੀਰੀਆ ਹਾਂਜੀ ਅਤੇ ਟ੍ਰੇਨਿੰਗ ਕਿੰਨੇ ਟਾਈਮ ਪੀਰੀਅਡ ਦੀ ਹੁੰਦੀ ਹੈ ਸਰ ਅਤੇ ਉਹ ਆਊ ਮਤਲਬ ਰੈਜੀਡੈਂਸ਼ੀਅਲੀ ਮਿਲੇਗੀ ਜਾਂ ਫਿਰ ਆਊਟ ਆਫ ਟਾਊਨ ਟਰੇਨਿੰਗ

ਹਾਂਜੀ ਠੀਕ ਹੈ ਸਰ ਠੀਕ ਹੈ ਹਾਂਜੀ ਥੈਂਕ ਯੂ ਸੋ ਮਚ ਓਕੇ ਜੀ ਓਕੇ